ਸਰ ਸਰਵਣ ਸਰ ਬੋਲਦੇ ਹੋ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਤੁਹਾਡਾ ਨੰਬਰ ਨਾ ਆਪਣੇ ਵੀਰੇ ਤੋਂ ਲਿਆ ਸੀ ਸਰ ਵੈਸੇ ਨਾ ਇੱਥੇ ਲੋਕਲ ਹੀ ਮਕਾਨ ਪਾਇਆ ਹੋਇਆ ਅਤੇ ਉਹਦੇ ਵਿੱਚ ਨਾ ਇੱਕ ਬਗੀਚਾ ਛੱਡਿਆ ਹੋਇਆ ਹਾਂਜੀ ਅਤੇ ਉਹਦੇ ਵਿੱਚ ਨਾ ਮੈਂ ਫਲਾਂ ਦੇ ਬੂਟੇ ਅਤੇ ਸਬਜ਼ੀਆਂ ਉਗਾਉਣੀਆਂ ਅਤੇ ਹਾਂਜੀ

ਹਾਂਜੀ ਸਰ ਜਿੱਦਾਂ ਹਾਂਜੀ ਹਾਂਜੀ ਹਾਂਜੀ ਜਿਵੇਂ ਹੁਣ ਅੱਗੇ ਸਰਦੀ ਦਾ ਮੌਸਮ ਆਉਣ ਵਾਲਾ ਅਤੇ ਉਹਦੇ ਵਿੱਚ ਵੀ ਅੱਗੇ ਆਪਾਂ ਕਿਹੜੇ ਕਿਹੜੇ ਵੀ ਬੂਟੇ ਲਗਾ ਸਕਦੇ ਹਾਂ ਜਾਂ ਸਬਜ਼ੀਆਂ ਕਿਹੜੀਆਂ ਉਗਾ ਸਕਦੇ ਹਾਂ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਸਰ ਅਤੇ ਸਰ ਆਪਾਂ ਹਾਂਜੀ ਅਤੇ ਸਰ ਆਪਾਂ ਗਰਮੀਆਂ 'ਚ ਕਿਹੜੇ ਮੰਨ ਲਓ ਬੂਟੇ ਵਗੈਰਾ ਅਤੇ ਫਲਾਂ ਵਾਲੇ ਬੂਟੇ ਜਾਂ ਸਬਜ਼ੀਆਂ ਕਿਹੜੀਆਂ ਉਗਾ ਸਕਦੇ ਹਾਂ ਉਹ

ਹਾਂਜੀ ਹਾਂਜੀ ਹਾਂਜੀ

ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਸਰ ਸਤਿ ਸ਼੍ਰੀ ਅਕਾਲ ਜੀ ਚਲੋ ਠੀਕ ਆ ਜੀ